ਵਿਗਿਆਨ ਅਤੇ ਤਕਨਾਲੋਜੀ ਵਿੱਚ ਤਰੱਕੀ ਨੇ ਸਿਹਤ ਸੰਭਾਲ ਖੇਤਰ ਨੂੰ ਬਹੁਤ ਸਾਰੀ ਸਹੂਲਤ ਦਿੱਤੀ ਹੈ ਬਹੁਤ ਸਾਰੀ ਸਹੂਲਤ ਦਿੱਤੀ ਹੈ ਕਿਉਂਕਿ ਕਿਉਂਕਿ ਬਿਮਾਰੀਆਂ ਬਿਮਾਰੀਆਂ ਦੀ ਬਿਮਾਰੀਆਂ ਦੇ ਇਲਾਜ ਲਈ ਸਭ ਤੋਂ ਜਿਆਦਾ ਵਿਗਿਆਨ ਅਤੇ ਤਕਨਾਲੋਜੀ ਨੇ ਹੀ ਸਹੂਲਤ ਦਿੱਤੀ ਹੈ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ ਲਈ ਵੱਖ ਵੱਖ ਤਰ੍ਹਾਂ ਦੀਆਂ ਦਵਾਈਆਂ ਦਵਾਈਆਂ ਦਾ ਦਵਾਈਆਂ ਦਾ ਸ ਸਰਚ ਵਿਗਿਆਨ ਅਤੇ ਤਕਨਾਲੋਜੀ ਵਿੱਚੋਂ ਹੀ ਹੋਇਆ ਹੈ ਕੋਵਿਨ ਐਪ ਨੇ ਕੋਵਿਡ ਮਹਾਂਮਾਰੀ ਵਿੱਚ ਸਾਡੀ ਬਹੁਤ ਮਦਦ ਕੀਤੀ ਹੈ ਕਿਉਂਕਿ ਕੋਵਿਨ ਐਪ ਥਰੂ ਕੋਵਿਨ ਐਪ ਥਰੂ ਅਸੀਂ ਆਪਦੀਆਂ ਕੋ ਕੋਵਿਡ ਸਬੰਧੀ ਕੋਵਿਡ ਸਬੰਧੀ ਹਰ ਇੱਕ ਜਾਣਕਾਰੀ ਪ੍ਰਾਪਤ ਕਰ ਸਕਦੇ ਹਰ ਇੱਕ ਜਾਣਕਾਰੀ ਪ੍ਰਾਪਤ ਕਰ ਸਕਦੇ ਸੀ ਅਤੇ ਆਪਣੇ ਆਪ ਨੂੰ ਕੋਵਿਡ ਤੋਂ ਬਚਾ ਸਕਦੇ ਸੀ ਇਸੇ ਕਰਕੇ ਵਿਗਿਆਨ ਅਤੇ ਤਕਨਾਲੋਜੀ ਨੇ ਬਹੁਤ ਜਿਆਦਾ ਹੈਲਪ ਕੀਤੀ